ਹੈਲੋ ਹਾਂ ਹਾਂਜੀ ਹਾਂਜੀ ਬੋਲੋ ਕੌਣ ਅੱਛਾ ਟਾਈਮਿੰਗ ਸਵੇਰੇ ਹੈਗੀ ਆ ਛੇ ਤੋਂ ਅੱਠ ਅਤੇ ਸ਼ਾਮ ਦਾ ਹੈ ਗਰੁੱਪ ਚਾਰ ਤੋਂ ਛੇ ਹਾਂਜੀ ਹਾਂਜੀ ਦੇਖ ਲਓ ਤੁਹਾਨੂੰ ਜਿਹੜੀ ਸੈਟਿੰਗ ਆਉਂਦੀ ਹੈ ਜੇ ਸਵੇਰ ਦੀ ਸੈਟਿੰਗ ਆਉਂਦੀ ਹੈ ਸੁਬਹਾ ਆ ਜਿਓ ਜੇ ਜੇ ਸ਼ਾਮ ਦੀ ਆਉਂਦੀ ਹੈ ਤਾਂ ਸ਼ਾਮੀ ਆ ਜਿਓ ਜੇ ਹਾਂਜੀ ਫਿਲਹਾਲ ਤਾਂ ਮੇਰੇ ਕੋਲ ਅਜੇ ਸਿਰਫ ਦੋ ਤਿੰਨ ਬੱਚੇ ਹੀ ਆ ਰਹੇ ਨੇ ਅਤੇ ਤੁਸੀਂ ਕਿੰਨੇ ਜਣੇ ਹੋ ਵੈਸੇ ਅੱਛਾ ਤਿੰਨ ਚਾਰ ਜਣੇ ਠੀਕ ਹੈ ਕੋਈ ਗੱਲ ਨਹੀਂ ਸੁਬਹਾ ਦੀ ਸੈਟਿੰਗ ਆਉਂਦੀ ਤਾਂ ਸੁਬਹਾ ਆ ਜਾਓ ਤੁਸੀਂ ਅੱਛਾ ਕਿੱਥੋਂ ਆਉਂਦੇ ਹੋ ਤੁਸੀਂ ਰਹਿੰਦੇ ਕਿੱਥੇ ਹੋ ਤੁਸੀਂ ਅੱਛਾ ਕੋਈ ਗੱਲ ਨਹੀਂ ਤੁਸੀਂ ਸ਼ਾਮੀ ਆ ਜਿਓ ਜੇ ਹਾਂਜੀ ਫੀਸ ਵਗੈਰਾ ਇੱਕ ਬੱਚੇ ਦੀ ਵੈਸੇ ਤਾਂ ਬਾਰਾਂ ਸੌ ਰੁਪਏ ਫੀਸ ਹੈ ਜੇ ਤੁਸੀਂ ਤਿੰਨ ਚਾਰ ਜਣੇ ਹੋ ਤਾਂ ਕੋਈ ਬੈਸਟ ਕਰ ਦਾਂਗੇ ਤੁਹਾਨੂੰ ਮੈਂ ਫਿਰ ਇੱਕ ਬੱਚੇ ਦੇ ਤੁਹਾਨੂੰ ਹਜ਼ਾਰ ਤੇ ਪੈ ਜੇਗੀ ਹਾਂਜੀ ਹਾਂਜੀ ਜੇ ਇੱਕ ਜਾਂ ਦੋ ਬੱਚੇ ਨੇ ਫਿਰ ਤਾਂ ਬਾਰਾਂ ਸੌ ਦੇ ਹਿਸਾਬ ਨਾਲ ਹੀ ਹੈ ਜੇ ਤੁਸੀਂ ਚਾਰ ਕੁ ਬੱਚੇ ਹੈਗੇ ਹੋ ਫਿਰ ਤੁਹਾਨੂੰ ਮੈਂ ਦੋ ਸੌ ਰੁਪਏ ਇੱਕ ਬੱਚੇ ਦਾ ਡਿਸਕਾਊਂਟ ਕਰਕੇ ਹਜ਼ਾਰ ਰੁਪਏ ਪਏਗੀ ਇੱਕ ਜਣੇ ਦੀ ਹਾਂਜੀ ਫਸਲਿਟੀ ਵਗੈਰਾ ਵੈਸੇ ਤਾਂ ਤੁਹਾਨੂੰ ਸਾਰੇ ਆਸਣ ਵਗੈਰਾ ਸਿਖਾਏ ਜਾਣਗੇ ਸਾਰੇ ਆਸਣ ਹੋ ਗਏ ਸਭ ਕੁਝ ਤੁਹਾਨੂੰ ਸਿਖਾਇਆ ਜਾਏਗਾ ਜਿਹਦੇ ਨਾਲ ਰਿਲੈਕਸ ਹੋ ਜਾਓਗੇ ਤੁਸੀਂ ਹਾਂਜੀ ਕਿੰਨੀ ਕੁ ਏਜ ਹੈ ਬੱਚਿਆਂ ਦੀ ਇਸਦੇ ਨਾਲ ਕੀ ਹੈ ਤੁਹਾਡਾ ਜਿਹੜਾ ਬੋਡੀ ਹੈ ਉਹ ਵਧੀਆ ਫਿੱਟ ਹੋ ਜੇਗੀ ਸਟਰੈਸ ਲੈਵਲ ਤੁਹਾਡਾ ਥੋੜ੍ਹਾ ਘੱਟ ਜੇਗਾ ਜੇ ਬੱਚਾ ਜ਼ਿਆਦਾ ਸਟਰੈਸ ਲੈ ਰਿਹਾ ਉਹ ਲੈਣਾ ਬੰਦ ਕਰ ਦੇਗਾ ਹਾਂਜੀ ਹਾਂਜੀ ਹਾਂਜੀ ਟੀ ਸ਼ਰਟ ਅਤੇ ਲੋਅਰ ਵਗੈਰਾ ਹੀ ਇੱਕ ਯੋਗਾ ਵਾਸਤੇ ਅਲੱਗ ਤੋਂ ਲੋਅਰ ਆਉਂਦੇ ਨੇ ਅਤੇ ਇੱਕ ਤੁਸੀਂ ਆਪਣਾ ਮੈਟ ਲੈ ਕੇ ਹੀ ਆਉਣਾ ਉਹ ਤੁਹਾਡਾ ਖੁਦ ਦਾ ਹੀ ਹੋਵੇਗਾ ਹਾਂਜੀ ਠੀਕ ਹੈ ਜੀ ਜਿਵੇਂ ਤੁਸੀਂ ਕਰੋ ਉਵੇਂ ਹੀ ਕਰ ਦਿਆ ਜੇ ਠੀਕ ਹੈ ਜੀ